ਮਾਰਤਿਟ ਸ਼ੇਅਰ ਬਾਜ਼ਾਰ ਜੋ ਕਿ ਬੰਬੇ ਦਿੱਲੀ ਵੱਡੇ ਵੱਡੇ ਸ਼ਹਿਰਾਂ ਵਿੱਚ ਹੁੰਦਾ ਹੈ ਉਸ ਨਾਲ ਜੇ ਆਪਾਂ ਚੀਜ਼ ਨੂੰ ਚੀਜ਼ ਸ਼ੇਅਰ ਬਾਜ਼ਾਰ ਵਿੱਚ ਅਸੀਂ ਜੇ ਆਪਾਂ ਕੋਈ ਚੀਜ਼ ਖਰੀਦ ਲੈਂਦੇ ਹਾਂ ਤਾਂ ਉਸ ਨਾਲ ਸਾਡ ਸਾਡੀ ਆਮਦਨ ਤੇਜ਼ ਹੋ ਜਾਂਦੀ ਹੈ ਅਤੇ ਤੇਜ਼ ਹੋ ਜਾਂਦੀ ਹੈ ਅਤੇ ਜੇ ਮਾਰਕੀਟ ਡਾਊਨ ਹੋਜੇ ਤਾਂ ਸਾਡੀ ਸਾਡੇ ਪੈਸੇ ਦੀ ਕੀਮਤ ਵੀ ਬਹੁਤ ਘੱਟ ਜਾਂਦੀ ਹੈ ਇਸ ਲਈ ਸਾਡੇ ਸਾਨੂੰ ਸੋਚ ਸਮਝ ਕੇ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਾਉਣਾ ਚਾਹੀਦਾ ਹੈ ਜਿਸ ਨਾਲ ਭਾਰਤ ਵਿੱਚ ਵਪਾਰ ਵਪਾਰ ਵਪਾਰ ਵੀ ਤੇਜ਼ ਹੋ ਜਾਂਦਾ ਹੈ ਇਸ ਲਈ ਸਾਨੂੰ ਜੀ ਜਿਹੜੀ ਵੀ ਚੀਜ਼ ਖਰੀਦਣੀ ਹੈ ਉਸ ਦੇ ਬਾਰੇ ਸਾਨੂੰ ਪਹਿਲਾਂ ਗਿਆਨ ਹੋਣਾ ਜ਼ਰੂਰੀ ਹੈ ਧੰਨਵਾਦ